ਭੰਗੜਾ ਪੰਜਾਬੀ ਸੱਭਿਆਚਾਰ ਦਾ ਲੋਕ ਨਾਚ ਹੈ ਭੰਗੜਾ ਪੰਜਾਬੀਆਂ ਦੇ ਖੂਨ ਵਿੱਚ ਹੈ ਕੋਈ ਵੀ ਜਨਮ ਕੋਈ ਵੀ ਤਿਉਹਾਰ ਲੋਹੜੀ ਦਿਵਾਲੀ ਸਭ ਤੋਂ ਪਹਿਲਾਂ ਭੰਗੜੇ ਨੂੰ ਹੀ ਪਾਇਆ ਜਾਂਦਾ ਹੈ ਭੰਗੜਾ ਪੰਜਾਬੀਆਂ ਦੇ ਖੂਨ ਵਿੱਚ ਇੰਨਾ ਰਚਿਆ ਹੋਵੇ ਵੀ ਨਿੱਕੀ ਜਿਹੀ ਖੁਸ਼ੀ ਆਵੇ ਤਾਂ ਬੰਦੇ ਦਾ ਮਨ ਕਰਦਾ ਹੈ ਨੱਚਣ ਨੂੰ ਬੰਦਾ ਨੱਚ ਉਠਦਾ ਜਿਵੇਂ ਕਿ ਵਿਸਾਖੀ ਵਿਸਾਖੀ 'ਤੇ ਫਸਲ ਦੀ ਵਾਢੀ 'ਤੇ ਕਿਸਾਨ ਭੰਗੜਾ ਪਾਉਂਦਾ ਹੈ ਅਤੇ ਟਹਿਲਦਾ ਫਿਰਦਾ ਵੀ ਅੱਜ ਉਹਦੀ ਫਸਲ ਆਈ ਹੈ ਉਸਦੀ ਖੁਸ਼ੀ ਦੇਖੀ ਨਹੀਂ ਜਾਂਦੀ ਉਸਦਾ ਮਨ ਅੰਦਰੋਂ ਨੱਚ ਉੱਠਦਾ ਹੈਗਾ ਜਦੋਂ ਮੈਂ ਸਕੂਲ ਟਾਈਮ ਵਿੱਚ ਪੜ੍ਹਦੀ ਸੀਗੀ ਤਾਂ ਮੈਂ ਮੈਂ ਗਿੱਧੇ ਵਿੱਚ ਪਾਰਟੀਸਪੇਟ ਕੀਤਾ ਸੀ ਅਤੇ ਮੇਰੇ ਫਰੈਂਡ ਸਰਕਲ ਨੇ ਭੰਗੜੇ ਵਿੱਚ ਪਾਰਟੀਸਪੇਟ ਕਰਦੇ ਭੰਗੜਾ ਬਹੁਤ ਵਧੀਆ ਨਾਚ ਹੈਗਾ ਭੰਗੜਾ ਭੰਗੜੇ ਨੂੰ ਮੈਂ ਇਹ ਕਹਿ ਸਕਦੀ ਹਾਂ ਵੀ ਇੱਕ ਕਸਰਤ ਵੀ ਹੈ ਵੀ ਜਦੋਂ ਵੀ ਭੰਗੜਾ ਕਿਸਾਨ ਪਾਉਂਦਾ ਹੈਗਾ ਤਾਂ ਉਸਦਾ ਦਿਲ ਨੱਚ ਉੱਠਦਾ ਉਹਦੀ ਐਕਸਰਸਾਈਜ਼ ਹੁੰਦੀ ਆ ਉਸਦੇ ਅੰਦਰੋਂ ਅੰਦਰਲੀਆਂ ਭਾਵਨਾਵਾਂ ਬਾਹਰ ਨਿਕਲਦੀਆਂ ਹਨ ਤਾਂ ਮੈਂ ਭੰਗੜੇ ਬਾਰੇ ਇਹੀ ਕਹਿਣਾ ਚਾਹੁੰਦੀ ਹਾਂ ਵੀ ਭੰਗੜਾ ਪੰਜਾਬੀਆਂ ਦੇ ਖੂਨ ਵਿੱਚ ਹੈ ਹਮੇਸ਼ਾਂ ਰਹੇਗਾ ਅਤੇ ਇਹ ਖੁਸ਼ੀ ਕਣਕ ਦੀ ਵਾਢੀ ਇੱਥੋਂ ਤੱਕ ਕਿ ਜੇ ਕੋਈ ਸਪੋਰਟਸ ਗੇਮ ਦੇ ਵਿੱਚ ਕੋਈ ਹਿੱਸਾ ਲੈ ਰਿਹਾ ਅਗਰ ਉਸ ਜਿੱਤ ਵੀ ਜਾਂਦਾ ਨਾ ਤਾਂ ਵੀ ਪੰਜਾਬੀ ਭੰਗੜਾ ਪਾਉਂਦਾ ਹੈ ਤਾਂ ਪੰਜਾਬੀਆਂ ਦਾ ਪੰਜਾਬੀ ਸੱਭਿਆਚਾਰ ਦਾ ਲੋਕ ਨਾਚ ਭੰਗੜਾ ਸਭ ਤੋਂ ਫੇਮਸ ਹੈ